ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਗੈਰੀ ਗੱਲ ਕਰ ਰਿਹਾ ਹਾਂ ਤੁਸੀਂ ਹਰਮਨ ਟਰੈਵਲਸ ਤੋਂ ਗੱਲ ਕਰ ਰਹੇ ਹੋ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਕੱਲ੍ਹ ਮੈਂ ਪਿੰਡ ਮੇਰੇ ਪਿੰਡ ਬਾਰਨ ਤੋਂ ਚੰਡੀਗੜ੍ਹ ਜਾਣ ਲਈ ਇੱਕ ਕੈਬ ਬੁੱਕ ਕੀਤੀ ਸੀ ਜਿਹਦਾ ਕਿ ਰੇਟ ਦੋ ਹਜ਼ਾਰ ਰੁਪਏ ਫਿਕਸ ਕੀਤਾ ਸੀ ਪਰ ਜਦੋਂ ਮੈਂ ਚੰਡੀਗੜ੍ਹ ਪਹੁੰਚਿਆ ਤਾਂ ਤੁਹਾਡੇ ਕੈਬ ਡਰਾਈਵਰ ਨੇ ਉੱਥੇ ਜਾ ਕੇ ਮੇਰੇ ਤੋਂ ਪੱਚੀ ਸੌ ਰੁਪਇਆ ਮੰਗਿਆ ਅਤੇ ਇਹ ਗੱਲ ਮੈਨੂੰ ਸਹੀ ਨਹੀਂ ਲੱਗੀ ਅਤੇ ਇਸ ਕਰਕੇ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹਾਂ ਕਿ ਇਹ ਮੇਰੇ ਨਾਲ ਪਹਿਲੀ ਵਾਰ ਹੋਇਆ ਹੈ ਕਿਉਂਕਿ ਉਸਨੇ ਪਹਿਲਾਂ ਰੇਟ ਫਿਕਸ ਕਰ ਲਿਆ ਸੀ ਪਰ ਉਸ ਤੋਂ ਬਾਅਦ ਰੇਟ ਜ਼ਿਆਦਾ ਮੰਗ ਰਿਹਾ ਹੈ ਇਹ ਗੱਲ ਮੈਨੂੰ ਵਧੀਆ ਨਹੀਂ ਲੱਗੀ ਤਾਂ ਕਿਰਪਾ ਕਰਕੇ ਇਸ ਗੱਲ ਦਾ ਹੱਲ ਕੱਢਿਆ ਜਾਵੇ